ਸਾਡਾ ਜੋ ਜੱਦੀ ਸ਼ਹਿਰ ਹੈ ਰੋਪੜ ਇਸ ਵਿੱਚ ਸਭ ਤੋਂ ਜ਼ਿਆਦਾ ਸਾਡੀ ਮਨਪਸੰਦ ਚੀਜ਼ ਸ੍ਰੀ ਅਨੰਦਪੁਰ ਸਾਹਿਬ ਹੈ ਜਿੱਥੇ ਕਿ ਸਾਡਾ ਤਖ਼ਤ ਬਣਿਆ ਹੋਇਆ ਹੈ ਇਸ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਨਾ ਕੀਤੀ ਗਈ ਸੀ ਇੱਥੇ ਜਾ ਕੇ ਅਸੀਂ ਬਹੁਤ ਜ਼ਿਆਦਾ ਸਕੂਨ ਮਹਿਸੂਸ ਕਰਦੇ ਹਾਂ ਸਾਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਅਸੀਂ ਆਪਣੇ ਗੁਰੂ ਦੀ ਗੋਦ ਵਿੱਚ ਬੈਠੇ ਹੋਈਏ